ਅਸੀਂ ਫੁੱਲਾਂ ਦੇ ਬੂਟੇ ਵੀ ਉਗਾਉਂਦੇ ਹਾਂ ਫਲਾਂ ਦੇ ਵੀ ਅਤੇ ਸਬਜ਼ੀਆਂ ਦੇ ਵੀ ਫੁੱਲਾਂ ਦੇ ਵਿੱਚ ਸਾਡੇ ਗੁਲਾਬ ਚਮੇਲੀ ਗੇਂਦਾ ਇਹ ਕਾਫੀ ਫੁੱਲ ਹਨ ਇਹਨਾਂ ਦੇ ਨਾਲ ਘਰ ਦਾ ਜਿਹੜਾ ਵਾਤਾਵਰਨ ਆ ਉਹ ਬਹੁਤ ਸੋਹਣਾ ਬਣ ਜਾਂਦਾ ਹੈ ਅਸੀਂ ਫਲਾਂ ਦੇ ਵੀ ਕੁਛ ਬੂਟੇ ਲਗਾਏ ਹਨ ਕਿਉਂਕਿ ਘਰ ਦੇ ਵਿੱਚ ਕੁਦਰਤੀ ਫਲ ਜਿਹੜੇ ਉਹ ਖਾਣ ਵਾਸਤੇ ਬਹੁਤ ਚੰਗੇ ਹੁੰਦੇ ਆ ਅਸੀਂ ਆਪਣੇ ਘਰ ਦੇ ਵਿੱਚ ਅਮਰੂਦ ਕਿੰਨੂ ਨਿੰਬੂ ਇਹ ਸਾਰੇ ਬੀਜੇ ਹੋਏ ਨੇ ਅਤੇ ਸਬਜ਼ੀਆਂ ਵੀ ਅਸੀਂ ਘਰ ਦੇ ਵਿੱਚ ਬੀਜਦੇ ਹਾਂ ਗੋਭੀ ਅਤੇ ਗਾਜਰਾਂ ਮਟਰ ਧਨੀਆ ਪਾਲਕ ਕਿਉਂਕਿ ਇਹ ਸਾਨੂੰ ਕੁਦਰਤੀ ਖੁਰਾਕ ਜਿਹੜੀ ਹੈ ਇਹ ਬਹੁਤ ਵਧੀਆ ਹੈ ਅਤੇ ਇਹਦੇ ਨਾਲ ਸਾਨੂੰ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਅਤੇ ਤਾਂ ਕਰਕੇ ਅਸੀਂ ਇਹਨਾਂ ਨੂੰ ਬੀਜਦੇ ਹਾਂ ਕਿਉਂਕਿ ਬਾਜ਼ਾਰ ਦੀ ਸਬਜ਼ੀ ਇੱਕ ਤਾਂ ਤਾਜ਼ੀ ਨਹੀਂ ਹੁੰਦੀ ਇਹ ਘਰ ਦੀ ਤਾਜ਼ੀ ਸਬਜ਼ੀ ਜਿਹੜੀ ਹੈ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਹੈ ਇਸ ਕਰਕੇ ਅਸੀਂ ਇਹ ਸਬਜ਼ੀਆਂ ਬੀਜਦੇ ਹਾਂ